ਹੈਲੋ ਸਵੀਗੀ ਤੋਂ ਗੱਲ ਕਰ ਰਹੇ ਹੋ ਜੀ ਹਾਂਜੀ ਸਾਨੂੰ ਆਰ ਕੇ ਰੈਸਟੋ ਫੂਡ ਪਲਾਜ਼ਾ ਤੋਂ ਖਾਣਾ ਚਾਹੀਦਾ ਅਤੇ ਇੱਥੋਂ ਇਕ ਛੋਟਾ ਜਿਹਾ ਗੈਟ ਟੂਗੈਦਰ ਸਾਡੇ ਘਰ ਅਤੇ ਔਡਰ ਮੇਰਾ ਨੋਟ ਕਰ ਲਓ ਇਹਦੇ 'ਚ ਸਾਨੂੰ ਜਿਹੜਾ ਇੰਡੀਅਨ ਖਾਣਾ ਚਾਹੀਦਾ ਉਹ ਨੋਟ ਕਰੋ ਪਹਿਲਾਂ ਦਾਲ ਮੱਖਣੀ ਦੋ ਪਲੇਟ ਕੜਾਹੀ ਪਨੀਰ ਦੋ ਮਿਕਸ ਵੈਜ ਇਕ ਦਸ ਬਟਰ ਨਾਨ ਨੋਟ ਕਰ ਲਿਆ ਜੀ ਹਾਂਜੀ ਇਹ ਚਾਈਨੀਜ ਵਿੱਚ ਨੋਟ ਕਰੋ ਜੀ ਨੂਡਲਸ ਚਾਹੀਦੇ ਤਿੰਨ ਪਲੇਟ ਅਤੇ ਤਿੰਨ ਪਲੇਟ ਹੀ ਸਪਰਿੰਗ ਰੋਲ ਦੋ ਪਲੇਟ ਮਨਚੂਰੀਅਨ ਅਤੇ ਇਸ ਤੋਂ ਇਲਾਵਾ ਸਾਨੂੰ ਚਾਹੀਦਾ ਇਟਾਲੀਅਨ ਦੇ ਵਿੱਚ ਫਰਮ ਫਰੈਸ਼ ਪੀਜਾ ਚਾਹੀਦੇ ਹੈ ਲਾਰਜ ਸਾਈਜ ਦੋ ਚਾਹੀਦੇ ਹੈ ਅਤੇ ਬਰਗਰ ਚਾਹੀਦੇ ਨੇ ਪੰਜ ਠੀਕ ਹੈ ਸਾਰਾ ਔਡਰ ਨੋਟ ਹੋ ਗਿਆ ਜੀ ਹਾਂਜੀ ਇਹ ਇਹ ਤੁਸੀਂ ਕਿੰਨੀ ਇਹ ਦੇਰ ਤੱਕ ਪਹੁੰਚਾ ਦੋਗੇ ਜੀ ਇਹ ਥੋੜ੍ਹੀ ਜਲਦੀ ਹੈ ਜਲਦੀ ਤੋਂ ਜਲਦੀ ਕੋਸ਼ਿਸ਼ ਕਰੋ ਇਕ ਘੰਟੇ 'ਚ ਸਾਨੂੰ ਔਡਰ ਪਲੀਜ ਡਿਲੀਵਰ ਕਰ ਦਿਓ ਠੀਕ ਹੈ ਜੀ ਨੋਟ ਹੋ ਗਿਆ ਨਾ ਸਾਰਾ ਔਡਰ ਤੇ ਇੱਕ ਗੱਲ ਦਾ ਧਿਆਨ ਰੱਖਣਾ ਕਿ ਜਿਹੜੀ ਪੈਕਿੰਗ ਹੈ ਬਹੁਤ ਵਧੀਆ ਹੋਣੀ ਚਾਹੀਦੀ ਹੈ ਢੱਕਣਾ ਉੱਤੇ ਨਾ ਟੇਪਿੰਗ ਵਗੈਰਾ ਜ਼ਰੂਰ ਕਰਵਾ ਦੇਣਾ ਤਾਂ ਜੋ ਖਾਣਾ ਜਿਹੜਾ ਬਿਲਕੁਲ ਗਰਮ ਰਹੇ ਠੀਕ ਹੈ ਜੀ ਹਾਂਜੀ ਓਕੇ ਜੀ